ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਤੁਸੀਂ ਹੈਪੀ ਸ਼ੋਪ ਤੋਂ ਬੋਲਦੇ ਹੋ ਜੀ ਜਿਹੜੀ ਮੈਂ ਤੁਹਾਤੋਂ ਮੋਬਾਇਲ ਮੰਗਵਾਇਆ ਤਾ ਭਾਅ ਜੀ ਉਹਦੀ ਡਿਲੀਵਰੀ ਮੈਨੂੰ ਮਿਲ ਗਈ ਹੈ ਭਾਅ ਜੀ ਜਦੋਂ ਮੈਂ ਉਹ ਡੱਬੇ 'ਚੋਂ ਕੱਢਿਆ ਭਾਅ ਜੀ ਪਹਿਲਾਂ ਤਾਂ ਉਹ ਦੇਖਣ ਨੂੰ ਹੀ ਪੁਰਾਣਾ ਲੱਗ ਰਿਹਾ ਭਾਅ ਜੀ ਫਿਰ ਦੂਸਰੀ ਗੱਲ ਇਹ ਜਦੋਂ ਆਪਾਂ ਚਲਾਉਂਦੇ ਹਾਂ ਤਾਂ ਉਹਦੇ ਸਪੀਕਰ ਵੀ ਖਰਾਬ ਹੈ ਅਤੇ ਜਦੋਂ ਆਪਾਂ ਫੋਟੋ ਖਿੱਚਦੇ ਹਾਂ ਤਾਂ ਉਹਦੀ ਫੋਟੋ ਵੀ ਕਲੀਅਰ ਨਹੀਂ ਆ ਰਹੀ ਭਾਅ ਜੀ ਅਤੇ ਦੂਸਰੀ ਗੱਲ ਇਹ ਹੈ ਕਿ ਇਹਦਾ ਗਲਾਸ ਵੀ ਟੁੱਟਿਆ ਹੋਇਆ ਪੁਰਾਣਾ ਪੁਰਾਣਾ ਲੱਗ ਰਿਹਾ ਤੁਸੀਂ ਮੈਨੂੰ ਮੈਨੂੰ ਲੱਗਦਾ ਵੀ ਮੈਨੂੰ ਪੁਰਾਣਾ ਫੋਨ ਦੇਤਾ ਹੈ ਭਾਅ ਜੀ ਪਲੀਜ਼ ਦੇਖੋ ਆਪਾਂ ਪੈਸੇ ਲਗਾਉਣੇ ਆ ਤਾਂ ਚੀਜ਼ ਲੈਣੀ ਹੈ ਠੀਕ ਹੈ ਅਤੇ ਕਿਰਪਾ ਕਰਕੇ ਇਹਨੂੰ ਵਾਪਸ ਲੈ ਲਓ ਜਾਂ ਤਾਂ ਮੈਨੂੰ ਫੋਨ ਨਵਾਂ ਦਿਉ ਜਾਂ ਫਿਰ ਮੇਰੇ ਪੈਸੇ ਵਾਪਸ ਕਰ ਦਿਉ ਧੰਨਵਾਦ